ਜੇਕਰ ਅਸੀਂ ਟਰੈਡਮਿਲ ਦੀ ਗੱਲ ਕਰੀਏ ਤਾਂ ਟਰੈਡਮਿਲ ਇੱਕ ਮਸ਼ੀਨ ਹੈ ਇਹ ਇੱਕ ਅਜਿਹੀ ਮਸ਼ੀਨ ਹੈ ਜਿਹੜੀ ਕਿ ਸਾਨੂੰ ਬਿਨਾਂ ਘਰ ਤੋਂ ਬਾਹਰ ਜਾਇਆ ਹੋਇਆ ਜਾਂ ਬਿਨਾਂ ਹੀ ਕਿਤੇ ਗਰਾਊਂਡ ਤੋਂ ਜਾਏ ਸਾਨੂੰ ਦੌੜਨ ਦਾ ਅਭਿਆਸ ਕਰਵਾਉਂਦੀ ਹੈ ਅਸੀਂ ਇਸ 'ਤੇ ਦੌੜ ਕੇ ਆਪਣੀ ਦੌੜਨ ਦੀ ਅਭਿਆਸ ਕਰ ਸਕਦੇ ਹਾਂ ਇਹ ਇੱਕ ਬਿਜਲੀ 'ਤੇ ਚੱਲਣ ਵਾਲਾ ਉਪਕਰਨ ਹੈ ਜਿਸ ਨੂੰ ਅਗਰ ਬਿਜਲੀ ਦਿੱਤੀ ਜਾਵੇ ਤਾਂ ਫਿਰ ਹੀ ਓਹ ਕੰਮ ਕਰਦਾ ਹੈ ਕਿਉਂਕਿ ਇਸ ਵਿੱਚ ਇੱਕ ਬਿਜਲੀ ਵਾਲੀ ਮੋਟਰ ਲੱਗੀ ਹੁੰਦੀ ਹੈ ਜੋ ਕਿ ਬਿਜਲੀ ਦੇ ਉੱਤੇ ਹੀ ਕੰਮ ਕਰਦੀ ਹੈ ਇਹ ਇੱਕ ਵਧੀਆ ਹੀ ਉਪਕਰਨ ਹੈ ਜੇਕਰ ਕਿਤੇ ਬਾਹਰ ਬਾਰਿਸ਼ ਹੁੰਦੀ ਹੋਵੇ ਤਾਂ ਅਸੀਂ ਇਸ ਦੇ ਉੱਪਰ ਹੀ ਆਪਣੀ ਅਭਿਆਸ ਕਰ ਸਕਦੇ ਹਾਂ ਸਾਡੇ ਅਭਿਆਸ ਵਿੱਚ ਕੋਈ ਰੁਕਾਵਟ ਵਗੈਰਾ ਨਹੀਂ ਪੈਂਦੀ ਅਤੇ ਦੂਜੇ ਹੀ ਪਾਸੇ ਅਗਰ ਅਸੀਂ ਇਸ ਨੂੰ ਰੋਜ਼ਾਨਾ ਯੂਸ ਦੇ ਵਜੋਂ ਗੱਲ ਕਰੀਏ ਤਾਂ ਰੋਜ਼ਾਨਾ ਵਰਤੋਂ ਲਈ ਇਹ ਏਡਾ ਵਧੀਆ ਹੀ ਵਿਕਲਪ ਨਹੀਂ ਹੈ ਕਿਉਂਕਿ ਸਾਨੂੰ ਜਦੋਂ ਅਸੀਂ ਦੌੜਦੇ ਹਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਔਕਸੀਜਨ ਦੀ ਲੋੜ ਹੁੰਦੀ ਹੈ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਫਰੈਂਸ਼ ਏਅਰ ਦੀ ਲੋੜ ਹੁੰਦੀ ਹੈ ਜਿਹੜੀ ਕਿ ਸਾਨੂੰ ਘਰ ਵਿੱਚ ਨਹੀਂ ਮਿਲ ਪਾਉਂਦੀ ਓਹ ਸਾਨੂੰ ਗਰਾਊਂਡ ਦੇ ਵਿੱਚ ਜਾ ਕੇ ਹਰਿਆਲੀ ਤੋਂ ਹੀ ਮਿਲਦੀ ਹੈ ਜਿਸ ਕਰਕੇ ਸਾਨੂੰ ਇਹ ਇੱਕ ਵਧੀਆ ਓਪਸ਼ਨ ਨਹੀਂ ਹੈੈ ਸਾਨੂੰ ਏ ਚੰਗੀ ਔਕਸੀਜਨ ਵਗੈਰਾ ਨਹੀਂ ਮਿਲ ਸਕਦੀ ਇਹਦੇ ਉੱਤੇ